ਹਾਂਜੀ ਪਹਿਲਾਂ ਸਰਕਾਰ ਨੇ ਖੇਤੀਬਾੜੀ ਦੇ ਕਨੈਕਸ਼ਨ ਅਤੇ ਘਰ ਦੇ ਕਨੈਕਸ਼ਨ ਇਕੱਠੇ ਹੁੰਦੇ ਸਨ ਅਤੇ ਹੁਣ ਕਈ ਸਾਲਾਂ ਤੋਂ ਸਰਕਾਰ ਨੇ ਕਨੈਕਸ਼ਨ ਅਲੱਗ ਅਲੱਗ ਕਰ ਦਿੱਤੇ ਗਏ ਨੇ ਜਿੱਦਾਂ ਕਿ ਸਾਨੂੰ ਪਹਿਲਾਂ ਬਹੁਤ ਮੁਸ਼ਕਲਾਂ ਆਈਆਂ ਮੁਸ਼ਕਲਾਂ ਆਉਂਦੀਆਂ ਸਨ ਜਿੱਦਾਂ ਕਿਉਂਕਿ ਬਿਜਲੀ ਰਾਤਾਂ ਨੂੰ ਕੱਟ ਲੱਗਣੇ ਜਾਂ ਹੋਰ ਆਦਿ ਕੁਛ ਅਤੇ ਸਾਨੂੰ ਕਾਫੀ ਸਾਹਮਣਾ ਕਰਨਾ ਪੈਂਦਾ ਸੀ ਅਤੇ ਹੁਣ ਕਈ ਕਈ ਸਾਲਾਂ ਤੋਂ ਸਰਕਾਰ ਨੇ ਕਨੈਕਸ਼ਨ ਅਲੱਗ ਅਲੱਗ ਕਰਕੇ ਸਾਡਾ ਕਾਫੀ ਜਾਣੀ ਕਿ ਬੈਨੀਫਿਟ ਕੀਤਾ ਆ ਹੁਣ ਕੱਟ ਬਹੁਤ ਘੱਟ ਲੱਗਦੇ ਹਨ ਅਤੇ ਸਰਕਾਰ ਨੇ ਇੱਕ ਹੋਰ ਵੀ ਵਧੀਆ ਸਕੀਮਾਂ ਦਿੱਤੀਆਂ ਗਈਆਂ ਹਨ ਜਿੱਦਾਂ ਕਿ ਸਾਨੂੰ ਕਨੈਕਸ਼ਨ ਲੈਣ ਲਈ ਸਾਨੂੰ ਬਿਜਲੀ ਘਰ ਤੋਂ ਫੋਮ ਲੈਣਾ ਪੈਂਦਾ ਹੈ ਅਤੇ ਫੋਮ ਫਿਲ ਕਰਕੇ ਸਰ ਆਪਣਾ ਸਰਪੰਚ ਤੋਂ ਮੋਹਰ ਮੂਹਰ ਲਗ ਲਗਵਾ ਕੇ ਸੈਨ ਕਰਵਾ ਕੇ ਤਾਂ ਸਾਨੂੰ ਫੋਮ ਜਮ੍ਹਾਂ ਫਿਲ ਕਰਕੇ ਜਮ੍ਹਾਂ ਕਰਵਾ ਕੇ ਅਤੇ ਸਾਨੂੰ ਕਨੈਕਸ਼ਨ ਦਿੱਤਾ ਜਾਂਦਾ ਹੈ ਜਦਕਿ ਅਸੀਂ ਉਹ ਖੇਤਾਂ ਵਿੱਚ ਅਸੀਂ ਕਨੈਕਸ਼ਨ ਆਪ ਲਗਾ ਕੇ ਜਾਂਦੇ ਹਨ ਅਤੇ ਹੋਰ ਵੀ ਕਾਫੀ ਬੈਨੀਫਿਟ ਦਿੰਦੇ ਹਨ ਅਤੇ ਸਰਕਾਰ ਨੇ ਸੋਲਰ ਸਿਸਟਮ 'ਤੇ ਲਗਵਾਉਣ 'ਤੇ ਸਾਨੂੰ ਸਾਨੂੰ ਸਬਸਿਟੀ ਵੀ ਦਿੰਦੇ ਹਨ ਅਤੇ ਅਸੀਂ ਉਹ ਜਦ ਮਰਜ਼ੀ ਚਲਾ ਸਕਦੇ ਹਾਂ

ਹੋਰ ਵੀ ਜਾਣੀ ਕਾਫੀ ਬੈਨੀਫਿਟ ਆ ਸਾਨੂੰ ਫਸਲ ਬੀਜਣ ਦੇ ਅਧਾਰ 'ਤੇ ਥੋੜ੍ਹੀ ਮੁਸ਼ਕਲਾਂ ਆਉਂਦੀਆਂ ਹਨ ਜਿੱਦਾਂ ਕਿ ਸਾਨੂੰ ਟਾਈਮ ਸਿਰ ਯੂਰੀਆ ਖਾਦ ਆਦਿ ਨਹੀਂ ਮਿਲਦਾ ਟਾਈਮ 'ਤੇ ਅਤੇ ਸਾਨੂੰ ਹੁਣ ਉਹ ਉਹ ਚੀਜ਼ ਦੀ ਦਿੱਕਤ ਆਉਂਦੀ ਹਨ ਅਤੇ ਬਿਜਲੀ ਦੇ ਅਧਾਰ 'ਤੇ ਤਾਂ ਹੁਣ ਚਲੋ ਸਰਕਾਰ ਬਹੁਤ ਸਹੀ ਕਰ ਰਹੀ ਹੈ ਜੀ